ਬੋੜੋ ਭਾਸ਼ਾ ਅਸਾਮ ਦੀ ਇੱਕ ਭਾਸ਼ਾ ਹੈ ਇਸਦੇ ਜ਼ਿਆਦਾਤਰ ਬੁਲਾਰੇ ਬ੍ਰਹਮਪੁੱਤਰੀ ਘਾਟੀ ਵਿੱਚ ਮਿਲਦੇ ਹਨ ਪੱਛਮੀ ਬੰਗਾਲ ਦੇ ਕਈ ਇਲਾਕਿਆਂ ਵਿੱਚ ਬੋੜੋ ਭਾਸ਼ਾ ਬੋਲੀ ਜਾਂਦੀ ਹੈ ਬੰਗਾਲੀ ਭਾਸ਼ਾ ਬੰਗਲਾਦੇਸ਼ ਅਤੇ ਭਾਰਤ ਦੇ ਪੱਛਮੀ ਬੰਗਾਲ ਦੇ ਉੱਤਰ ਪੂਰਵੀ ਭਾਰਤ ਦੇ ਕਈ ਰਾਜਾਂ ਵਿੱਚ ਬੋਲੀ ਜਾਂਦੀ ਹੈ ਭਾਸ਼ਾਈ ਪਰਿਵਾਰ ਦੀ ਨਜ਼ਰ ਵਿੱਚ ਇਹ ਹਿੰਦ ਯੂਰਪ ਭਾਸ਼ਾ ਪਰਿਵਾਰ ਦਾ ਮੈਂਬਰ ਹੈ ਇਸ ਪਰਿਵਾਰ ਦੀਆਂ ਹੋਰ ਪ੍ਰਮੁੱਖ ਭਾਸ਼ਾਵਾਂ ਪੰਜਾਬੀ ਹਿੰਦੀ ਨੇਪਾਲੀ ਗੁਜਰਾਤੀ ਅਸਾਮੀ ਆਦਿ ਭਾਸ਼ਾਵਾਂ ਹਨ ਬੰਗਲਾ ਬੋਲਣ ਵਾਲਿਆਂ ਦੀ ਗਿਣਤੀ ਲਗਭਗ ਤੇਈ ਕਰੋੜ ਹੈ ਅਤੇ ਇਹ ਸੰਸਾਰ ਦੀ ਛੇਵੀਂ ਸਭ ਤੋਂ ਵੱਡੀ ਭਾਸ਼ਾ ਹੈ ਇਸ ਨੂੰ ਬੋਲਣ ਵਾਲੇ ਬੰਗਲਾਦੇਸ਼ ਅਤੇ ਭਾਰਤ ਦੇ ਇਲਾਕੇ ਸੰਸਾਰ ਦੇ ਬਹੁਤ ਸਾਰੇ ਹੋਰ ਦੇਸ਼ ਵੀ ਹੀ ਹਨ ਬੰਗਾਲੀ ਭਾਸ਼ਾ ਅਤੇ ਬੋੜੋ ਭਾਸ਼ਾ ਜ਼ਿਆਦਾਤਰ ਭਾਰਤ ਦੇ ਪੱਛਮੀ ਬੰਗਾਲ ਵਿੱਚ ਬੋਲੀ ਜਾਂਦੀ ਹੈ ਇਹ ਭਾਸ਼ਾ ਦ ਅਸਾਮ ਦੇ ਕਈ ਰਾਜਾਂ ਵਿੱਚ ਬੋਲੀ ਜਾਂਦੀ ਹੈ ਬੋੜੋ ਭਾਸ਼ਾ ਦੇ ਮੁਕਾਬਲੇ ਬੰਗਾਲੀ ਭਾਸ਼ਾ ਦੇ ਬੋਲਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ ਬੰਗਾਲੀ ਭਾਸ਼ਾ ਦੇ ਬੋਲਣ ਵਾਲਿਆਂ ਦੀ ਗਿਣਤੀ ਤੇਈ ਕਰੋੜ ਹੈ